ਹਾਂਜੀ ਪੇਂਡੂ ਖੇਤਰ ਵਿੱਚ ਸਿੱਖਿਆ ਪ੍ਰਣਾਲੀ ਨੂੰ ਬਿਹਤਰ ਕਰਨ ਦੇ ਲਈ ਏ ਮਾੜਾ ਮੋਟਾ ਯਤਨ ਕੀਤੇ ਤਾਂ ਗਏ ਨੇ ਠੀਕ ਹੈ ਜੀ ਜਿਵੇਂ ਹੁਣ ਨਵੀਂ ਸਰਕਾਰ ਆਈ ਆ ਆਮ ਆਦਮੀ ਪਾਰਟੀ ਦੀ ਤਾਂ ਇਹਨਾਂ ਨੇ ਟੀਚਰਸ ਨੂੰ ਅਧਿਆਪਕਾਂ ਨੂੰ ਟ੍ਰੇਨਿੰਗ 'ਤੇ ਭੇਜਿਆ ਬਾਹਰਲੇ ਮੁਲਕਾਂ ਦੇ ਵਿੱਚ ਤਾਂ ਕਿ ਉਹ ਸਿੱਖ ਕੇ ਆਉਣ ਉੱਥੇ ਕਿਵੇਂ ਚੀਜ਼ਾਂ ਚੱਲਦੀਆਂ ਨੇ ਕਿਵੇਂ ਉੱਥੇ ਬੱਚਿਆਂ ਨੂੰ ਪੜ੍ਹਾਇਆ ਜਾਂਦਾ ਤਾਂ ਕਿ ਉਹ ਇੱਥੇ ਆ ਕੇ ਸਾਡੇ ਬੱਚਿਆਂ ਨੂੰ ਵੀ ਉਵੇਂ ਹੀ ਟ੍ਰੇਨ ਕਰ ਸਕਣ ਪੜ੍ਹਾ ਸਕਣ ਤਾਂ ਇੱਕ ਵਧੀਆ ਉਪਰਾਲਾ ਸੀਗਾ ਬਾਕੀ ਤੁਹਾਨੂੰ ਪਹਿਲਾਂ ਮਿਡ ਡੇ ਮੀਲ ਦੀ ਆਪਾਂ ਗੱਲ ਕੀਤੀ ਆ ਹਾਲਾਂਕਿ ਉਹ ਚਲੋ ਢਿੱਡ ਦੀ ਗੱਲ ਆ ਪਰ ਜੇ ਢਿੱਡ ਰੱਜਿਆ ਹੋਉਗਾ ਤਾਂ ਹੀ ਬੱਚਾ ਪੜ੍ਹ ਵੀ ਸਕਦਾ ਹੈ ਜੇ ਗਰੀਬਾਂ ਦੇ ਬੱਚਿਆਂ ਨੂੰ ਖਾਣਾ ਪੌਸ਼ਟਿਕ ਮਿਲੂਗਾ ਤਾਂ ਉਹ ਉਹ ਪੜ੍ਹਾਈ ਵੀ ਵਧੀਆ ਕਰ ਸਕਦੇ ਨੇ ਬਾਕੀ ਇਸ ਤੋਂ ਇਲਾਵਾ ਕੁਛ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਹੁਣ ਅਧਿਆਪਕਾਂ ਦੇ ਉੱਤੇ ਵੀ ਛੱਡੀਆਂ ਗਈਆਂ ਨੇ ਜਿਵੇਂ ਫੰਡ ਵਗੈਰਾ ਆਉਂਦਾ ਹੈ ਜੀ ਉਹਨੂੰ ਵਰਤਣਾ ਬੱਚਿਆਂ ਦੀ ਸੁੱਖ ਸਹੂਲਤਾਂ ਦੇ ਲਈ ਮਨਰੇਗਾ ਵਗੈਰਾ ਤਾਂ ਮਤਲਬ ਫੰਡਿੰਗ ਕੁਛ ਜਿਹੜੀ ਹੈਗੀ ਆ ਉਹ ਟੀਚਰਸ ਹੁਣ ਆਪਣੇ ਹਿਸਾਬ ਨਾਲ ਜ਼ਰੂਰਤ ਦੇ ਹਿਸਾਬ ਨਾਲ ਸਕੂਲ ਦੇ ਵਿੱਚ ਉਹ ਚੀਜ਼ ਕਰਵਾ ਸਕਦੇ ਨੇ ਬਾਕੀ ਕੁਛ ਜਿਹੜੇ ਪੇਂਡੂ ਖੇਤਰਾਂ ਦੇ ਵਿੱਚ ਮੁੱਠੀ ਭਰ ਬੱਚੇ ਸਕੂਲਾਂ 'ਚ ਨਹੀਂ ਭੇਜੇ ਜਾਂਦੇ ਉਹਦਾ ਸਿੱਧਾ ਸਿੱਧਾ ਕਾਰਨ ਹੈਗੀ ਆ ਜੀ ਆਮਦਨ ਜਿਹੜੇ ਗਰੀਬ ਪਰਿਵਾਰ ਨੇ ਉਹਨਾਂ ਦੇ ਵਿੱਚ ਜੇ ਬੱਚੇ ਵੱਧ ਵੀ ਨੇ ਹੁੰਦੇ ਨੇ ਆਪਾਂ ਦੇਖਦੇ ਹੀ ਹਾਂ ਉਹਨਾਂ ਦਾ ਸਿੱਧਾ ਸਿੱਧਾ ਕਾਰਨ ਹੈ ਕਿ ਉਹ ਚਾਹੁੰਦੇ ਨੇ ਕਿ ਸਾਡੇ ਕੋਲ ਆਮਦਨ ਵੱਧ ਆਵੇ ਸੋ ਬੱਚੇ ਨੇ ਪੜ੍ਹ ਲਿਖ ਕੇ ਕਰਨਾ ਕੀ ਆ ਕਹਿੰਦੇ ਉਹ ਫੇਰ ਸੋਚਦੇ ਨੇ ਵੀ ਦਿਹਾੜੀ ਓ ਕਰਨੀ ਆ ਮਜ਼ਦੂਰੀ ਓ ਕਰਨੀ ਹੈ ਤਾਂ ਇਹਨੂੰ ਪੜ੍ਹਾ ਕੇ ਕੀ ਕਰਨਾ ਹੈ ਇਹ ਤੋਂ ਚੰਗਾ ਇਹ ਤੋਂ ਦਿਹਾੜੀ ਕਰਵਾ ਕੇ ਕੰਮ ਕਰਵਾ ਕੇ ਚਾਰ ਪੈਸੇ ਹੀ ਘਰ ਆਉਣ ਆਉਂਦੇ ਹੋਣਗੇ ਸੋ ਮੇਜਰ ਸਮੱਸਿਆ ਜਿਹੜੀ ਇਹੀ ਹੈ ਕਿ ਉਹ ਸਮਝਦੇ ਨਹੀਂ ਕਿ ਪੜ੍ਹਾ ਲਿਖਾ ਕੇ ਬੱਚੇ ਨੂੰ ਅਸੀਂ ਉਹਦੇ ਉ ਉਹਦੇ ਸਕਿੱਲ ਇੰਪਰੂਵ ਕਰਵਾ ਲਵਾਂਗੇ ਉਹਦੇ ਵਿੱਚ ਕੁਛ ਕਾਬਲੀਅਤ ਪੈਦਾ ਕਰ ਦੇਵਾਂਗੇ ਜਿਹਦੇ ਨਾਲ ਵੱਧ ਵਧੀਆ ਤਰੀਕੇ ਨਾਲ ਕਮਾ ਸਕਦਾ ਹੈ ਮਜ਼ਦੂਰੀ ਤੋਂ ਇਲ ਇਲਾ ਉਹ ਛੁੱਟ ਛੁੱਟ ਸਕਦਾ ਉਹ ਪਰ ਉਹਨਾਂ ਦੀ ਮਾਨਸਿਕਤਾ ਇੱਥੇ ਹੀ ਖੜ੍ਹੀ ਹੈ ਕਿ ਵੀ ਬੱਚਿਆਂ ਨੂੰ ਸਕੂਲ ਭੇਜ ਕੇ ਵੀ ਕੁਛ ਐਡਾ ਹੁੰਦਾ ਨਹੀਂ ਕਿਉਂਕਿ ਜਿਹੜੇ ਪੜ੍ਹ ਲਿਖ ਜਾਂਦੇ ਨੇ ਉਹ ਕਿਹੜਾ ਨੌਕਰੀਆਂ ਲੱਗ ਜਾਂਦੇ ਨੇ ਠੀਕ ਹੈ ਜੀ ਹਾਲਾਂਕੀ ਉਹ ਵੱਖਰੀ ਗੱਲ ਹੈ ਕਿ ਪੜ੍ਹ ਲਿਖ ਕੇ ਨੌਕਰੀ ਲੱਗਣਾ ਵੱਖਰੀ ਗੱਲ ਹੈ ਪੜ੍ਹ ਲਿਖ ਕੇ ਸਮਾਜ ਦੇ ਵਿੱਚ ਸਮਾਜ ਦੇ ਹਾਣੀ ਹੋਣਾ ਵੱਖਰੀ ਗੱਲ ਆ ਉਹ ਚੀਜ਼ ਨਹੀਂ ਸਮਝਦੇ ਹੈਗੇ ਸੋ ਸਮੱਸਿਆ ਹੈਗੀਆਂ ਨੇ ਪਰ ਉਹ ਬਹੁਤ ਘੱਟ ਗਈਆਂ ਹੁਣ ਬਹੁਤ ਘੱਟ ਪੇਰੈਂਟਸ ਹੈਗੇ ਨੇ ਮਾਪੇ ਹੈਗੇ ਨੇ ਜਿਹੜੇ ਆਪਣੇ ਬੱਚਿਆਂ ਨੂੰ ਸਕੂਲ ਨਹੀਂ ਭੇਜਦੇ ਜ਼ਿਆਦਾਤਰ ਭੇਜਦੇ ਨੇ